ਵਿਕਾਸਸ਼ੀਲ ਸੰਸਾਰ ਜਿਹੜਾ ਹੈ ਸਮੇਂ ਦੇ ਹਿਸਾਬ ਨਾਲ਼ ਇਹਦੀ ਜ਼ਰੂਰਤ ਏ ਬਹੁਤ ਜ਼ਿਆਦਾ ਏ ਅਤੇ ਕੰਪੀਟੀਸ਼ਨ ਚੱਲ ਰਿਹਾ ਏ ਦੁਨੀਆਂ ਦੀ ਹਰੇਕ ਕੰਨਟਰੀ ਦੇ ਵਿੱਚ ਆਪਸ ਵਿੱਚ ਅਤੇ ਬਹੁਤ ਸਾਰੀਆਂ ਕੰਨਟਰੀਆਂ ਜਿਹੜੀਆਂ ਵਿਕਾ ਵਿਕਸਿਤ ਹੋ ਚੁੱਕੀਆਂ ਅਤੇ ਬਹੁਤ ਸਾਰੀਆਂ ਵਿਕਾਸ ਅਤੇ ਜਿਹੜੇ ਅੰਦਰ ਵਾਲੇ ਪ੍ਰੋਸੈਸ ਚੋਂ ਨਿਕਲ ਰਹੀਆਂ ਹੈ ਇਹਦੇ ਬਾਰੇ ਇੱਕ ਪਾਸੇ ਦੇਖਿਆ ਜਾਵੇ ਤਾਂ ਬਹੁਤ ਵਧੀਆ ਵੀ ਹੈ ਕਿ ਜਿਹੜੀ ਬੰਦਾ ਹੈ ਚੰਨ 'ਤੇ ਪਹੁੰਚ ਗਿਆ ਏ ਪਰ ਜੇ ਦੂਜੇ ਪਾਸੇ ਦੇਖੇ ਦੇਖਿਆ ਜਾਵੇ ਇਹ ਜਿਹੜੀ ਇਹ ਜਿਹੜੇ ਵਿਕਾਸ ਹੈ ਇਹ ਖ਼ਰਾਬ ਵੀ ਕਰ ਰਿਹਾ ਏ ਜਿਵੇਂ ਫਾਈਵ ਜੀ ਸ ਲੌਂਚ ਹੋ ਗਿਆ ਹੈ ਕੁਛ ਇੱਧਰ ਆਪਾਂ ਪੰਛੀਆਂ ਦੇ ਬਾਰੇ ਸੋਚਦੇ ਨਹੀਂ ਹਾਂ ਕੁਛ ਵੀ ਅਤੇ ਉਹ ਵਿਚਾਰੇ ਖ਼ਤਮ ਹੁੰਦੇ ਜਾ ਰਹੇ ਹੈ ਰੇਡੀਏਸ਼ਨਜ਼ ਵੱਧ ਗਈਆਂ ਏ ਔਰ ਵਿਕਾਸ ਹੋਣਾ ਆਪਣੀ ਥਾਂ 'ਤੇ ਠੀਕ ਹੈ ਪਰ ਉਸਦੇ ਜਿਹੜੇ ਕੁਛ ਡਿਸਐਡਵਾਟੇਂਜ ਵੀ ਹੈ